ਹੈਲੋ ਸਰ ਤੁਸੀਂ ਮੀਸ਼ੋ ਤੋਂ ਬੋਲਦੇ ਜੋ ਮੈਂ ਤੁਹਾਡੇ ਕੋਲੋਂ ਇੱਕ ਸੂਟ ਮੰਗਵਾਇਆ ਸੀ ਮੇਰਾ ਸੂਟ ਬਹੁਤ ਹੀ ਵਧੀਆ ਰਿਹਾ ਬਹੁਤ ਸੋਹਣਾ ਰਿਹਾ ਬੜੇ ਸੋਹਣੇ ਫੁੱਲ ਉਹਦੇ ਵਿੱਚ ਮੈਂ ਪਾ ਕੇ ਕਾਫ਼ੀ ਮੈਰਿਜ 'ਤੇ ਗਈ ਬੜੇ ਵਿਆਹ ਵੇਖੇ ਉਹਦੇ ਨਾਲ ਉਹਦੇ ਉੱਤੇ ਪਰ ਫੁੱਲ ਬਹੁਤ ਸੋਹਣੇ ਆ ਉਹਦਾ ਕਲਰ ਵੀ ਬਹੁਤ ਸੋਹਣਾ ਆ ਉਹਦੇ ਨਾਲ ਜਿਹੜਾ ਦੁਪੱਟਾ ਸੀ ਉਹ ਵੀ ਬਹੁਤ ਸੋਹਣਾ ਆ ਦੁਪੱਟੇ ਦੇ ਉੱਤੇ ਲਾਲ ਲਾਲ ਫੁੱਲ ਬਣੇ ਹੋਏ ਨੇ ਕੰਧੇ 'ਤੇ ਬਹੁਤ ਸੋਹਣੀ ਕਿਨਾਰੀ ਬਣੀ ਆ ਦੁਪੱਟੇ ਦੀ ਮੈਨੂੰ ਸਾਰਿਆਂ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਲਿਆ ਹੈ ਸੂਟ ਮੈਂ ਤੁਹਾਡਾ ਲਿੰਕ ਦੇ ਦਿੱਤਾ ਮੈਂ ਕਿਹਾ ਮੈਂ ਮੀਸ਼ੋ ਤੋਂ ਖਰੀਦਿਆ ਵਾ ਉਹ ਕਹਿੰਦੇ ਚੱਲ ਠੀਕ ਆ ਮੈਨੂੰ ਬਹੁਤ ਹੀ ਵਧੀਆ ਲੱਗਾ ਸੂਟ ਅਤੇ ਮੈਂ ਇਹਨੂੰ ਪਾ ਕੇ ਕਾਫ਼ੀ ਵਾਰ ਗਈ ਹਾਂ ਮੈਂ ਧੋਤਾ ਵੀ ਆ ਇਹ ਧੋਣ ਨਾਲ ਵੀ ਖਰਾਬ ਨਹੀਂ ਹੋਇਆ ਬਿਲਕੁਲ ਖਰਾਬ ਨਹੀਂ ਹੋਇਆ ਇਹਦਾ ਜਿਹੜਾ ਕਲਰ ਵਾ ਨਾ ਬਲੈਕ ਕਲਰ ਦਾ ਵਾ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਆ ਕਲਰ ਇਹਦੇ ਵਿੱਚ ਫੁੱਲ ਬੜੇ ਪਿਆਰੇ ਨੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਵਾ ਮੈਂ ਆਰਾਮ ਨਾਲ ਦੁਪੱਟਾ ਸਿਰ 'ਤੇ ਵੀ ਲੈ ਲੈਂਦੀ ਹਾਂ ਡਿੱਗਦਾ ਵੀ ਨਹੀਂ ਆ ਕੱਪੜਾ ਵੀ ਬਹੁਤ ਵਧੀਆ ਰਿਹਾ ਵਾ ਬਹੁਤ ਸੋਹਣਾ ਰਿਹਾ ਵਾ ਇਹ ਸੂਟ ਦੇ ਨਾਲ ਨਾਲ ਫਲਾਵਰ ਬਣੇ ਹੋਏ ਆ ਪੌਂਚਿਆਂ ਦੇ ਉੱਤੇ ਵੀ ਸੂਟ ਦਿਆਂ ਦੇ ਪੌਂਚਿਆਂ ਦੇ ਉੱਤੇ ਫਲਾਵਰ ਬਣੇ ਆ ਬਹੁਤ ਸੋਹਣੇ ਫਲਾਵਰ ਹੈਗੇ ਨੇ ਸੂਟ ਦੀ ਸ਼ਾਈਨਿੰਗ ਵੀ ਬਹੁਤ ਜ਼ਿਆਦਾ ਆ ਬੜੀ ਸ਼ਾਈਨਿੰਗ ਆ ਸੂਟ ਦੀ ਮੈਂ ਹਾਲੇ ਵੀ ਪਾਉਂਦੀ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਇਆ ਇਹ ਕੱਪੜੇ ਨੂੰ ਮੈਂ ਕਿੰਨੇ ਧੋਅ ਪਾ ਲਏ ਆ ਖਰਾਬ ਬਿਲਕੁਲ ਨਹੀਂ ਹੋਇਆ ਦੁਪੱਟੇ 'ਚ ਤਾਂ ਬਾਹਲੀ ਸ਼ਾਈਨਿੰਗ ਆ ਨਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿੰਨਾਂ ਤੁਸੀਂ ਮੈਨੂੰ ਇੰਨਾ ਵਧੀਆ ਸੂਟ ਦਿੱਤਾ ਇੰਨਾ ਵਧੀਆ ਸੂਟ ਮੈਂ ਤੁਹਾਡਾ ਪਾਇਆ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ